ਅੱਜ ਕੱਲ੍ਹ ਦੇ ਸਮੇਂ ਵਿੱਚ ਟੈਕਨੋਲਜੀ ਆ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਹਰ ਘਰ ਵਿੱਚ ਮੋਬਾਇਲ ਫੋਨ ਹੋ ਗਿਆ ਲੈਪਟੋਪ ਹੋ ਗਿਆ ਕੰਪਿਊਟਰ ਹੋ ਗਿਆ ਬਹੁਤ ਜ਼ਿਆਦਾ ਵੱਧ ਚੁੱਕਿਆ ਅੱਜ ਕੱਲ੍ਹ ਤਾਂ ਬ ਬੱਚਿਆਂ ਦੀਆਂ ਪੜ੍ਹਾਈਆਂ ਵੀ ਕਰੋਨਾ ਤੋਂ ਬਾਅਦ ਫੋਨ ਉੱਤੇ ਹੀ ਸ਼ੁਰੂ ਹੋ ਗਈਆਂ ਹਨ ਕਿ ਫੋਨ ਉੱਤੇ ਸ਼ੁਰੂ ਹੋ ਗਈਆਂ ਹਨ ਅਤੇ ਹਰੇਕ ਘਰ ਵਿੱਚ ਹਰੇਕ ਇਨਸਾਨ ਕੋਲ ਫੋਨ ਲੈਪਟਾਪ ਜਾਂ ਕੰਪਿਊਟਰ ਤਾਂ ਹੁੰਦਾ ਹੀ ਹੈਗਾ ਜਿੰਨਾ ਅੱਜ ਕੱਲ੍ਹ ਅੱਜ ਕੱਲ੍ਹ ਦਾ ਟੈਕਨੋਲਜੀ ਦੀ ਮਦਦ ਨਾਲ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ਾਂ ਲ ਵਿੱਚ ਬੈਠੇ ਲੋਕਾਂ ਨਾਲ ਵੀਡੀਓ ਕਾਲ ਗੱਲਾਂ ਵੀ ਕਰ ਸਕਦੇ ਹਾਂ ਪਹਿਲਾਂ ਇਹ ਸਭ ਨਹੀਂ ਹੁੰਦਾ ਸੀਗਾ ਟੈਕਨੋਲੋਜੀ ਬਹੁਤ ਵੱਧ ਚੁੱਕੀ ਹੈ